ਮੰਨੋਰੰਜਨ ਉਸ ਖਾਲੀ ਸਮੇਂ ਦਾ ਸਦ ਉਪਯੋਗ ਹੈ ਜਿਸ ਨੂੰ ਕਈ ਵਾਰ ਅਸੀਂ ਅਜਾਈ ਗਵਾ ਦਿੰਦੇ ਹਾਂ ਕਹਿੰਦੇ ਹਨ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਜੇਕਰ ਬੱਚਾ ਵਿਹਲਾ ਹੈ ਤਾਂ ਉਹ ਉਲਟ ਪੁਲਟ ਵਿਚਾਰਾਂ ਵਿੱਚ ਫਸ ਸਕਦਾ ਹੈ ਇੰਝ ਗਲਤ ਵਿਚਾਰਾਂ ਵਿੱਚ ਫਸਣ ਤੋਂ ਚੰਗਾ ਹੈ ਕਿ ਬੱਚੇ ਨੂੰ ਕਿਸੇ ਚੰਗੀ ਮੰਨੋਰੰਜਕ ਗਤੀਵਿਧੀ ਵੱਲ ਲਗਾ ਦਿੱਤਾ ਜਾਵੇ ਮੰਨੋਰੰਜਨ ਮਨੁੱਖ ਦੀ ਬੌਧਿਕ ਵਿਕਾਸ ਵਿੱਚ ਸਹਾਇਤਾ ਕਰਦਾ ਹੈ ਬੱਚੇ ਆਪਣਾ ਮੰਨੋਰੰਜਨ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਰਾਹੀਂ ਕਰ ਸਕਦੇ ਹਨ ਜਿਨ੍ਹਾਂ ਵਿੱਚ ਆਰਟ ਅਤੇ ਕਰਾਫਟ ਪੇਂਟਿੰਗ ਡਾਂਸ ਖੇਡਾਂ ਅਤੇ ਹੋਰ ਕਈ ਗਤੀਵਿਧੀਆਂ ਸ਼ਾਮਿਲ ਹਨ ਜੋ ਕਿ ਬੱਚੇ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ ਮੰਨੋਰੰਜਨ ਦੀਆਂ ਗਤੀਵਿਧੀਆਂ ਵਿੱਚ ਲਾਇਆ ਸਮਾਂ ਕਦੇ ਵੀ ਖਾਲੀ ਨਹੀਂ ਜਾਂਦਾ ਸਗੋਂ ਇਹਨਾਂ ਗਤੀਵਿਧੀਆਂ ਵਿੱਚ ਲਾਇਆ ਸਮਾਂ ਕਈ ਵਾਰ ਦੁੱਗਣਾ ਫ਼ਲ ਦਿੰਦਾ ਹੈ ਇਸ ਲਈ ਬੱਚੇ ਦੀਆਂ ਮੰਨੋਰੰਜਕ ਗਤੀਵਿਧੀਆਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ